ਹਾਂਜੀ ਮੈਂ ਆਪਣੀ ਵੋਕਲ ਥਕਾਵਟ ਨੂੰ ਠੀਕ ਰੱਖਣ ਦੇ ਲਈ ਮੈਂ ਆਪਣੇ ਗਾਣੇ ਦੇ ਵਿੱਚ ਆਪਣੀ ਆਵਾਜ਼ ਨੂੰ ਧਿਆਨ ਨਾਲ ਵਰਤਦੀ ਹਾਂ ਅਤੇ ਜਿੱਥੇ ਲੋੜ ਪਵੇ ਸਾਹ ਦੀ ਉੱਥੇ ਸਾਹ ਲੈਂਦੀ ਹਾਂ ਆਪਣੀ ਆਵਾਜ਼ ਦੀ ਸੁਰੱਖਿਆ ਲਈ ਮੈਂ ਕਈ ਤਕਨੀਕਾਂ ਵਰਤਦੀ ਹਾਂ ਜਿਹਦੇ ਨਾਲ ਸਾਹ ਨੂੰ ਸ ਮੇਰੀ ਪੂਰੀ ਆਵਾਜ਼ ਜਿਹੜੀ ਉਹ ਠੀਕ ਰਹੇ ਮੈਨੂੰ ਸਾਹ ਨਾ ਜ਼ਿਆਦਾ ਚੜ੍ਹੇ ਥਕਾਵਟ ਨਾ ਹੋਵੇ ਮੈਂ ਆਪਣੇ ਗਲੇ ਦਾ ਖਾਸ ਧਿਆਨ ਰੱਖਦੀ ਹਾਂ ਕਈ ਮੈਂ ਗਲੇ ਦੀ ਆਵਾਜ਼ ਆਪਣੀ ਸਹੀ ਰੱਖਣ ਦੇ ਲਈ ਆਪਣਾ ਗਰਮ ਪਾਣੀ ਪੀਂਦੀ ਹਾਂ ਅਤੇ ਆਪਣੇ ਕਈ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰਦੀ ਹਾਂ ਅਤੇ ਹਰੇ ਆਪਣਾ ਸਵੇਰ ਨੂੰ ਉੱਠ ਕੇ ਗਰਮ ਪਾਣੀ ਪੀਂਦੀ ਹਾਂ ਜਿਹਦੇ ਨਾਲ ਗਲਾ ਸਾਫ ਰਹੇ ਅਤੇ ਅਤੇ ਕਈ ਤਰ੍ਹਾਂ ਦੀਆਂ ਕਸਰਤਾਂ ਵੀ ਕਰਦੀਆਂ ਹਾਂ ਜਿਹਦੇ ਨਾਲ ਮੇਰਾ ਗਲਾ ਪੂਰਾ ਠੀਕ ਰਹੇ ਤਾਂ ਜੋ ਮੈਨੂੰ ਕੋਈ ਵੀ ਬੋਲਣ ਦੇ ਵਿੱਚ ਗਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਅਤੇ ਕਈ ਤਰ੍ਹਾਂ ਦੇ ਯੋਗੇ ਵੀ ਕਰਦੀ ਹਾਂ ਕਈ ਤਰ੍ਹਾਂ ਦੀ ਐਕਸਰਸਾਈਜ਼ ਵੀ ਕਰਦੀ ਹਾਂ ਜਿਹਦੇ ਨਾਲ ਮੇਰਾ ਗਲਾ ਜਿਹੜਾ ਉਹ ਠੀਕ ਰਹੇ